ਹਾਲ ਹੀ ਦੇ ਸਾਲਾਂ ਦੇ ਵਿੱਚ ਜੋ ਕਿ ਆਪਣੇ ਦੇਸ਼ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਮੋਦੀ ਸਰਕਾਰ ਹੈ ਉਸ ਨੇ ਇਹ ਜਿਹੇ ਕੰਮ ਕੀਤੇ ਹਨ ਜੋ ਕਿ ਅਰਥ ਚਾਰੇ ਦੇ ਵਿਕਾਸ ਦੇ ਵਾਧੇ ਲਈ ਹੋਏ ਹਨ ਜਿਵੇਂ ਕਿ ਵਿਕਾਸ ਕਿਵੇਂ ਹੋਇਆ ਤੁਹਾਡਾ ਕਹਿਣ ਦਾ ਮਤਲਬ ਉਹਦਾ ਮਤਲਬ ਹੈ ਕਿ ਜਿਵੇਂ ਕਿ ਭਾਰਤ ਹਿਮਾਲਿਆ ਰੋਡ ਹੋ ਗਏ ਕੰਪਨੀਆਂ ਹੋ ਗਏ ਏਜੰਸੀਆਂ ਹੋ ਗਏ ਜਿਹਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲਿਆ ਜੋ ਭਾਰਤ ਹਿਮਾਲਿਆ ਰੋਡ ਮਿਲਿਆ ਉਹਦੇ ਦੇ ਵਿੱਚ ਆਪਣਿਆਂ ਬਾਹਰਲੀਆਂ ਕੰਟਰੀਆਂ ਦੇ ਨਾਲ ਲੈਣ ਦੇਣ ਦਾ ਵਪਾਰ ਆਪਣੇ ਰੋਡ ਰਾਹੀਂ ਜੋ ਕਿ ਆਪਾਂ ਨੂੰ ਹਵਾਈ ਯਾਤਰਾ ਦੇ ਨਾਲੋਂ ਇਹ ਰੋਡ ਵਿਧੀ ਦੇ ਰਾਹੀਂ ਆਪਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਆਪਣਾ ਮਾਲ ਬਾਹਰਲੇ ਦੇਸ਼ਾਂ ਨੂੰ ਵੇਚਿਆ ਜਾ ਰਿਹਾ ਜਾਂ ਫਿਰ ਉਹਨਾਂ ਤੋਂ ਲਿਆ ਜਾ ਰਿਹਾ ਉਹਨਾਂ ਬਾਰੇ ਦੇਖਿਆ ਜਾਵੇ ਤਾਂ ਉਹਦੇ ਨਾਲ ਵਿਕਾਸ ਦੇ ਵਿਕਾਸ ਹੋਇਆ ਆਪਣੇ ਅਰਥਚਾਰੇ ਦੇ ਵਿੱਚ ਅਤੇ ਜੋ ਇੰਟਰਨੈਟ ਬੈਂਕਿੰਗ ਚੱਲੀ ਹੈ ਉਸ ਦੇ ਨਾਲ ਵੀ ਆਪਣੀ ਬਹੁਤ ਆਪਣੇ ਬਾਹਰਲੀਆਂ ਕੰਟਰੀਆਂ 'ਚ ਜਾਂ ਹੋਰ ਜਿੱਥੇ ਵੀ ਲੈਣ ਦੇਣ ਕਰਨਾ ਸੌਖਾ ਹੋ ਗਿਆ ਜਿਵੇਂ ਕਿ ਪਹਿਲਾਂ ਆਪਾਂ ਨੂੰ ਆਪਾਂ ਨੂੰ ਜਾਣਾ ਪੈਂਦਾ ਉੱਧਰਲੀ ਬੈਂਕਾਂ ਦੇ ਬ ਵਗੈਰਾਂ ਵਿੱਚ ਜਾਣਾ ਪੈਂਦਾ ਤਾਂ ਹੋ ਗਿਆ ਡਿਜ਼ੀਟਲ ਭੁਗਤਾਨ ਜੋ ਕਿ ਆਪਣਾ ਗੂਗਲ ਪੇ ਹੋ ਗਿਆ ਫੋਨਪੇ ਹੋ ਗਿਆ ਹੋਰ ਹੋ ਗਿਆ ਉਹਦੇ ਰਾਹੀਂ ਆਪਾਂ ਨੇ ਪੇਮੈਂਟ ਕਰਨੀ ਹੈ ਬਾਹਰ ਬੈਠਿਆਂ ਨੂੰ ਉਰੇ ਨੂੰ ਜਿਹਨੂੰ ਮਰਜ਼ੀ ਕਰਨੀ ਆ ਇੱਕ ਮਿੰਟ ਦੇ ਵਿੱਚ ਆਪਾਂ ਆਪਣੇ ਡਿਜ਼ੀਟਲ ਭੁਗਤਾਨ ਕਰ ਸਕਦੇ ਹਾਂ